ਪੰਜਾਬ ਵਿੱਚ ਜਿਵੇਂ ਕਿ ਚਾਰ ਖੇਤਰ ਨੇ ਮਾਝਾ ਮਾਲਵਾ ਦੁਆਬਾ ਪੁਆਧੀ ਅਤੇ ਦਸ ਕਿਲੋਮੀਟਰ ਬਾਅਦ ਕਹਿ ਸਕਦੇ ਹਾਂ ਆਪਾਂ ਜਿਹੜੀ ਭਾਸ਼ਾ ਹੈ ਉਹ ਬਦਲ ਜਾਂਦੀ ਹੈ ਮੈਂ ਵੈਸੇ ਦੁਆਬੇ ਵਿੱਚ ਰਹਿਣ ਵਾਲੀ ਹਾਂ ਦੁਆਬੀ ਭਾਸ਼ਾ ਮੈਨੂੰ ਆਉਂਦੀ ਹੈ ਪਰ ਮੈਨੂੰ ਜੋ ਸਿੱਖਣ ਦੀ ਜਾਂ ਵਰਤੀ ਹੈ ਮੈਂ ਮਾਲਵੇ ਦੀ ਵੀ ਸਿੱਖੀ ਹੋਈ ਹੈ ਅਤੇ ਮਾਲਵੇ ਵਿੱਚ ਕਿੱਦਾਂ ਦੀ ਬਜਾਏ ਆਪਾਂ ਕਿਵੇਂ ਵਰਤਦੇ ਨੇ ਸੋ ਮੈਂ ਅਗਾਂਹ ਵੀ ਕਾਫੀ ਕੋਸ਼ਿਸ਼ ਕਰਦੀ ਰਵਾਂਗੀ ਕਿ ਮੈਂ ਖੇਤਰੀ ਉਪਭਾਸ਼ਾ ਸਿੱਖਾਂ